ਪੰਜਾਬ ਵਿੱਚ ਬਹੁਤ ਸਾਰੇ ਬੈਂਕ ਹਨ ਜਿਹੜੇ ਕਿ ਅਲੱਗ ਅਲੱਗ ਤਰ੍ਹਾਂ ਦੀ ਸਰਵਿਸ ਦਿੰਦੇ ਹਨ ਜਿਵੇਂ ਕਿ ਲੋਨ ਸਰਵਿਸ ਲੋਨ ਸਰਵਿਸ ਵਿੱਚ ਜਿਵੇਂ ਕਿ ਸਾਨੂੰ ਸਾਡੇ ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਯਾ ਫਿਰ ਘਰ ਬਣਾਉਣ ਲਈ ਯਾ ਫਿਰ ਕੋਈ ਵੀ ਪੜ੍ਹਾਈ ਦੇ ਖਰਚੇ ਲਈ ਸਾਨੂੰ ਲੋਨ ਸਰਵਿਸ ਮਿਲ ਸਕਦੀ ਹੈ ਜੋ ਕਿ ਅਸੀਂ ਕਿਸ਼ਤਾਂ ਵਿੱਚ ਭੁਗਤਾਨ ਕਰ ਸਕਦੇ ਹਾਂ ਜੋ ਸਾਡੇ ਲਈ ਬੜੀ ਆਸਾਨ ਰਹਿੰਦਾ ਫਿਰ ਅਗਰ ਗੱਲ ਕਰੀਏ ਕ੍ਰੈਡਿਟ ਕਾਰਡ ਦੀ ਤਾਂ ਕ੍ਰੈਡਿਟ ਕਾਰਡ ਦੀ ਮਦਦ ਨਾਲ ਅਸੀਂ ਸ਼ੋਪਿੰਗ ਕਰ ਸਕਦੇ ਹਾਂ ਜਿਸ ਦਾ ਕਿ ਭੁਗਤਾਨ ਸਾਡੇ ਜੋ ਸੈਲਰੀ ਆਉਂਦੀ ਆ ਉਸ ਦੇ ਵਿੱਚੋਂ ਇੰਸਟੋਲਮੈਂਟਸ ਵਿੱਚ ਹੋ ਜਾਂਦਾ ਜੋ ਕਿ ਬਹੁਤ ਛੋਟੀ ਛੋਟੀ ਇੰਸਟੋਲਮੈਂਟ ਦੇ ਵਿੱਚ ਹੁੰਦਾ ਏ ਆ ਅੱਗੇ ਬੈਂਕ ਬਹੁਤ ਸਾਰੇ ਬੀਮਾ ਪੋਲੀਸਿਸ ਵੀ ਦਿੰਦਾ ਜਿਵੇਂ ਕਿ ਹੈਲਥ ਇੰਸ਼ੋਰੈਂਸ ਹੋ ਗਿਆ ਲਾਈਫ ਇੰਸ਼ੋਰੈਂਸ ਹੋ ਗਿਆ ਹੈਲਥ ਵਿੱਚ ਜਿਵੇਂ ਕਿ ਜਦੋਂ ਅਸੀਂ ਬਿਮਾਰ ਹੁੰਦੇ ਆ ਫਿਰ ਕੁਝ ਵੀ ਆ ਤਾਂ ਸ ਸਾਡਾ ਜੋ ਇਲਾਜ ਹੈ ਉਹ ਜੋ ਅਸੀਂ ਕਿਸ਼ਤਾਂ ਦਿੱਤੀਆਂ ਹੁੰਦੀਆਂ ਬੈਂਕ ਵਿੱਚ ਉਹਨਾਂ ਦੇ ਆਧਾਰ 'ਤੇ ਸਾਡਾ ਮਤਲਬ ਘੱਟ ਖਰਚੇ ਵਿੱਚ ਹੀ ਸਾਡਾ ਇਲਾਜ ਹੋ ਜਾਂਦਾ ਬੈਂਕ ਵਿੱਚ ਜੋ ਕਿ ਸਾਡੇ ਲਈ ਬੜਾ ਫਿਰ ਆਸਾਨੀ ਰਹਿੰਦੀ ਆ ਸਾਨੂੰ ਆਪਣਾ ਇਲਾਜ ਕਰਾਉਣ ਵਿੱਚ